ਹੈਲੋ ਹਾਂਜੀ ਕੌਣ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਜੀ ਹਾਂਜੀ ਹਾਂਜੀ ਹਾਂਜੀ ਦੱਸਾਂਗੇ ਜ਼ਰੂਰ ਜੀ ਬਹੁਤ ਵਧੀਆ ਇਤਿਹਾਸ ਇੱਥੋਂ ਦਾ ਬਹੁਤ ਚੜ੍ਹਦੀ ਕਲਾ ਵਾਲਾ ਇਤਿਹਾਸ ਹੈ ਅਤੇ ਬਹੁਤ ਹੀ ਵਧੀਆ ਇੱਥੇ ਆਪਣੇ ਮੇਨ ਹੈਗਾ ਸ਼ਹਿਰ ਦੇ ਵਿਚਾਲੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਅਤੇ ਇਹ ਇਹ ਇੱਥੇ ਆਪਣੇ ਦਸਮ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਜੰਗ ਲੜੀ ਸੀਗੀ ਅਤੇ ਇੱਧਰ ਆਪਣੀ ਉਹ ਆਪਣੇ ਇੱਧਰ ਜਲਾਲਾਬਾਦ ਰੋਡ 'ਤੇ ਗੁਰਦੁਆਰਾ ਸਾਹਿਬ ਆ ਜਾਂਦੇ ਹੈਗੇ ਆ ਟਿੱਬੀ ਸਾਹਿਬ ਗੁਰਦੁਆਰਾ ਹੈਗਾ ਇੱਧਰ ਇੱਥੇ ਉੱਚਾ ਟਿੱਬਾ ਸੀਗਾ ਬਹੁਤ ਸਮੇਂ ਪਹਿਲਾਂ ਅਤੇ ਇਸ ਟਿੱਬੇ 'ਤੇ ਗੁਰੂ ਸਾਹਿਬ ਜੀ ਨੇ ਆ ਕੇ ਅਤੇ ਆਪਦਾ ਮੋਰਚਾ ਲਾਇਆ ਸੀ ਅਤੇ ਇੱਥੋਂ ਤੀਰ ਗੁਰੂ ਸਾਹਿਬ ਛੱਡਦੇ ਸੀਗੇ ਅਤੇ ਟੁੱਟੀ ਗੰਢੀ ਸਾਹਿਬ ਤੀਰ ਉੱਥੇ ਜਾ ਕੇ ਮੁਗਲਾਂ ਦੀ ਫੌਜ ਸੀ ਅਤੇ ਉੱਥੇ ਜਾ ਕੇ ਤੀਰ ਮੁਗਲਾਂ ਦੀ ਫੌਜ ਨੂੰ ਲੱਗਦੇ ਸੀਗੇ ਅਤੇ ਇੱਥੇ ਫਿਰ ਗੁਰੂ ਸਾਹਿਬ ਜੀ ਨੇ ਜੰਗ ਪ੍ਰਾਪਤ ਕੀਤੀ ਸੀ ਅਤੇ ਫਿਰ ਇੱਥੇ ਚਾਲੀ ਮੁਕਤਿਆਂ ਨੇ ਜੰਗ ਲੜੀ ਸੀ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੇ ਵਰ ਦਿੱਤੇ ਸੀਗੇ ਅਤੇ ਨਾਲ ਹੀ ਉਹਨਾਂ ਨੇ ਇੱਥੋਂ ਦੇ ਮੁਕਤਸਰ ਸ਼ਹਿਰ ਵਸਾਇਆ ਅਤੇ ਨਾਲ ਉਹਨਾਂ ਨੇ ਕਿਹਾ ਵੀ ਇਹ ਮਾਲਵਾ ਮਾਲਾ ਮਾਲ ਹੋਊਗਾ ਕਹਿੰਦੇ ਕਿਸੇ ਟਾਈਮ ਫਿਰ ਵੀ ਬਹੁਤ ਕਿਰਪਾ ਹੋਊਗੀ ਇਸ ਸੇ ਅਤੇ ਜੋ ਵੀ ਕਹਿੰਦੇ ਸੀਗੇ ਮੁਕਤਸਰ ਦੇ ਵਿੱਚ ਆਊਗਾ ਰਹੇਗਾ ਇਤਿਹਾਸ ਨੂੰ ਸੁਣੇਗਾ ਪੜ੍ਹੇਗਾ ਮੰਨੇਗਾ ਅਤੇ ਕਹਿੰਦੇ ਸੀ ਵੀ ਉਹਦੀ ਮੁਕਤੀ ਹੋ ਜੂਗੀ ਉਹਦੀ ਮੁਕਤੀ ਹੋ ਜੂਗੀ ਅਤੇ ਇਹ ਬਹੁਤ ਹੀ ਤਕੜਾ ਇਤਿਹਾਸ ਹੈ ਅਤੇ ਸਾਰੇ ਇਤਿਹਾਸਾਂ ਦੇ ਵਿੱਚ ਕਹਿੰਦਾ ਕਹਾਉਂਦਾ ਇਤਿਹਾਸ ਹੈ ਇਹ ਅਤੇ ਇਸੇ ਹੀ ਨਮਿਤ ਆਪਣੇ ਇੱਧਰ ਜਲਾਲਾਬਾਦ ਰੋਡ 'ਤੇ ਆ ਜਾਂਦੇ ਆ ਟਿੱਬੀ ਸਾਹਿਬ ਰੋਡ 'ਤੇ ਟਿੱਬੀ ਸਾਹਿਬ ਗੁਰਦੁਆਰਾ ਆ ਜਾਂਦਾ ਅਤੇ ਰਕਾਬਸਰ ਗੁਰਦੁਆਰਾ ਇੱਥੇ ਜਦੋਂ ਗੁਰੂ ਸਾਹਿਬ ਘੋੜੇ 'ਤੇ ਚੜ੍ਹ ਕੇ ਉੱਧਰ ਜਾਣ ਲੱਗੇ ਸੀ ਟੁੱਟੀ ਗੰਢੀ ਮਾਂ ਮਹਾਂ ਸਿੰਘ ਦੀ ਟੁੱਟੀ ਗੰਢਣ ਜਾਂਦੇ ਸੀਗੇ ਤਾਂ ਉਦੋਂ ਜਦੋਂ ਘੋੜੇ 'ਤੇ ਚੜ੍ਹਨ ਲੱਗਦੇ ਤਾਂ ਉਹ ਰਕਾਬ ਟੁੱਟ ਜਾਂਦੀ ਆ ਅਤੇ ਉਹ ਰਕਾਬ ਅੱਜ ਵੀ ਸ਼ੀਸ਼ੇ ਵਿੱਚ ਜੜ੍ਹਤ ਉੱਥੇ ਗੁਰਦੁਆਰਾ ਰਕਾਬਸਰ ਬਣਿਆ ਉੱਥੇ ਉਹਦੇ ਵਿੱਚ ਜੜ੍ਹਤ ਸ਼ੀਸ਼ੇ 'ਚ ਪਈ ਹੈ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਤੁਸੀਂ ਆਓ ਤੁਹਾਨੂੰ ਦਰਸ਼ਨ ਕਰਾਵਾਂਗੇ ਅਸੀਂ ਅਤੇ ਇੱਕ ਆਪਣੇ ਇੱਧਰ ਹੈਗਾ ਆਪਣੇ ਖੂਹ ਸਾਹਿਬ ਗੁਰਦੁਆਰਾ ਇਹ ਖੂਹ ਸਾਹਿਬ 'ਤੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਜਲ ਕੱਢਿਆ ਸੀ ਕਿਉਂਕਿ ਟਿੱਬੇ ਟਿੱਬੇ ਸੀ ਉਦੋਂ ਇੱਥੇ ਪੀਣ ਵਾਸਤੇ ਪਾਣੀ ਹੈ ਨਹੀਂ ਸੀਗਾ ਚਾਰੇ ਪਾਸੇ ਟਿੱਬੇ ਟਿੱਬੇ ਸੀ ਫਿਰ ਸੰਗਤਾਂ ਨੇ ਬੇਨਤੀ ਕੀਤੀ ਵੀ ਜਲ ਹ ਪਾਣੀ ਹੈ ਨਹੀਂ ਪੀਣ ਨੂੰ ਇੱਥੇ ਫਿਰ ਉਹਨਾਂ ਨੇ ਤੀਰ ਮਾਰ ਕੇ ਜਲ ਕੱਢਿਆ ਸੀਗਾ ਖੂਹ ਸਾਹਿਬ ਗੁਰਦੁਆਰਾ ਫਿਰ ਹੋਰ ਥੋੜ੍ਹਾ ਅੱਗੇ ਜਾ ਕੇ ਅਤੇ ਫਿਰ ਇੱਧਰ ਦਾਤਣ ਸਾਹਿਬ ਗੁਰਦੁਆਰਾ ਆ ਜਾਂਦਾ ਅਤੇ ਉਹ ਦਾਤਣ ਸਾਹਿਬ ਗੁਰਦੁਆਰੇ ਉੱਥੇ ਇੱਥੋਂ ਖੂਹ ਤੋਂ ਜਲ ਕੱਢ ਕੇ ਪਾਤਸ਼ਾਹ ਨੇ ਗੜਵੀ ਵਿੱਚ ਜਲ ਲੈ ਕੇ ਅਤੇ ਅੱਗੇ ਜਾ ਕੇ ਉੱਥੇ ਜਾ ਕੇ ਉਹ ਆਪਣਾ ਦਾਤਣ ਕਰਦੇ ਪਏ ਸੀ ਬੈਠੇ ਅਤੇ ਫਿਰ ਇੱਕ ਮੁਸਲਮਾਨ ਨੇ ਪਿੱਛੋਂ ਦੀ ਆ ਕੇ ਅਤੇ ਗੁਰੂ ਸਾਹਿਬ 'ਤੇ ਵਾਰ ਕਰਨ ਲੱਗੇ ਉਹ ਅਤੇ ਪਾਤਸ਼ਾਹ ਜਾਣੀ ਜਾਣ ਸੀ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਉਹ ਜਿਹੜੇ ਗੜਵੀ ਵਿੱਚ ਜਲ ਸੀਗਾ ਲੈ ਕੇ ਬੈਠੇ ਦਾਤਣ ਕਰਨ ਵਾਸਤੇ ਇਹਨਾਂ ਕੋਲ ਜਲ ਲੈ ਕੇ ਬੈਠੇ ਸੀ ਉਹਨਾਂ ਨੇ ਗੜਵਾ ਮਾਰ ਕੇ ਉਹ ਮੁਸਲਮਾਨ ਦਾ ਮੁਸਲਮਾਨ ਦਾ ਦੀ ਸਮਾਪਤੀ ਕੀਤੀ ਅਤੇ ਉੱਥੇ ਫਿਰ ਗੁਰੂ ਸਾਹਿਬ ਜੀ ਨੇ ਉਹਨੂੰ ਸਰਾਪ ਦਿੱਤਾ ਰਹਿੰਦੀ ਦੁਨੀਆ ਤੱਕ ਤੇਰੇ ਜੁੱਤੇ ਵੱਜਦੇ ਰਹਿਣਗੇ ਜਿੰਨੀ ਸੰਗਤ ਆਊਗੀ ਅਤੇ ਉੱਥੇ ਜੁੱਤੇ ਮਾਰੇਗੀ ਜੁੱਤੇ ਮਾ ਜੁੱਤੇ ਮਾਰੇਗੀ ਅਤੇ ਜਿ ਜਿੰਨਾ ਜਿਹੜਾ ਵੀ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਨਾ ਅਤੇ ਉਹ ਜਿਹੜੇ ਵੀ ਸ਼ਰਧਾਲੂ ਆਉਂਦੇ ਉਹ ਇੱਧਰ ਜ਼ਰੂਰ ਹੋ ਕੇ ਜਾਣਾ ਹੁੰਦਾ ਉਹਨਾਂ ਨੇ ਕਿਉਂਕਿ ਜੇ ਉਹ ਇੱਧਰ ਆ ਕੇ ਇਹਦੇ ਜੁੱਤੇ ਨਾ ਮਾਰਨਗੇ ਤਾਂ ਉਹਨਾਂ ਦੀ ਯਾਤਰਾ ਨਹੀਂ ਸਫਲ ਹੋਣੀ ਅਤੇ ਇਸ ਕਰਕੇ ਹਾਂਜੀ ਹਾਂਜੀ ਇਸ ਕਰਕੇ ਇੱਧਰ ਆਉਣਾ ਬਹੁਤ ਜ਼ਰੂਰੀ ਹੈ ਅਤੇ ਉੱਧਰ ਭਾਈ ਮਹਾਂ ਸਿੰਘ ਟੁੱਟੀ ਗੰਢੀ ਸਾਹਿਬ ਫਿਰ ਜਦੋਂ ਅਖੀਰ 'ਤੇ ਭਾਈ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਂ ਸਿੰਘ ਦਾ ਬਦਾਵਾ ਪਾੜਿਆ ਸੀ ਅਤੇ ਉਹਨਾਂ ਨੂੰ ਵਰ ਦਿੱਤੇ ਸੀਗੇ ਅਤੇ ਉਹ ਉੱਥੇ ਟੁੱਟੀ ਗੰਢੀ ਇਸ ਕਰਕੇ ਉਹਦਾ ਨਾਂ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਕਿਉਂਕਿ ਉੱਥੇ ਜਦੋਂ ਆਪਾਂ ਅਨੰਦਪੁਰ ਸਾਹਿਬ ਸੀਗੇ ਨਾ ਹਾਂਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ